ਮੈਂ ਦਿੱਲੀ ਤੋਂ ਜੈਪੁਰ ਜਾਣ ਲਈ ਰੇਲ ਟਿਕਟ ਬੁੱਕ ਕਰਵਾਉਣੀ ਹੈ ਮੇਰੀ ਯਾਤਰਾ ਦੀ ਮਿਤੀ ਵੀਹ ਨਵੰਬਰ ਦੋ ਹਜ਼ਾਰ ਚੌਵੀ ਹੈ ਅਸੀਂ ਤਿੰਨ ਜਾਣੇ ਹਾਂ ਮੇਰੀ ਟਿਕਟ ਬੁੱਕ ਕਰਨ ਵਿੱਚ ਮੇਰੀ ਮਦਦ ਕੀਤੀ ਜਾਵੇ ਮੇਰੀ ਆਈ ਡੀ ਤਿੰਨ ਚਾਰ ਪੰਜ ਛੇ ਸੱਤ ਅਤੇ ਪਾਸਵਰਡ ਅਰਸ਼ਦੀਪ ਹੈ ਕਿਰਪਾ ਕਰਕੇ ਮੇਰੀ ਟਿਕਟ ਬੁੱਕ ਕਰਨ ਵਿੱਚ ਮਦਦ ਕੀਤੀ ਜਾਵੇ